ਹੈਲੋ ਤੁਸੀਂ ਅਮਨਦੀਪ ਸਿੰਘ ਬੋ ਗੱਲ ਕਰ ਰਹੇ ਹੋ ਪ੍ਰੋਪਰਟੀ ਬਾਰੇ ਗੱਲ ਕਰਨੀ ਸੀਗੀ ਮੈਨੂੰ ਨਾ ਇੱਕ ਘਰ ਚਾਹੀਦਾ ਸੀਗਾ ਜਿਹਦੇ ਵਿੱਚ ਤਿੰਨ ਕੁ ਰੂਮ ਹੋਣ ਅਤੇ ਇੱਕ ਦ ਇੱਕ ਲਿਵਿੰਗ ਰੂਮ ਅਤੇ ਕਿਚਨ ਵਗੈਰਾ ਸੈਪਰੇਟ ਹੋਣ ਠੀਕ ਹੈ ਅਤੇ ਥੋੜਾ ਅ ਆਸ ਪਾਸ ਦਾ ਏਰੀਆ ਵਿਊ ਕਾਫੀ ਅੱਛਾ ਹੋਵੇ ਅਤੇ ਕਿੰਨੇ ਕੁ ਬਜ਼ਟ ਦਾ ਤੱਕ ਮੈਨੂੰ ਇਹ ਮਿਲ ਜਾਏਗਾ ਨਹੀਂ ਨਹੀਂ ਸਰ ਜਿਵੇਂ ਨਾ ਅ ਆਸ ਪਾਸ ਤਾਂ ਥੋੜ੍ਹਾ ਸ਼ਾਂਤੀ ਹੋਵੇ ਕਿਉਂਕਿ ਐਕਚੁਲੀ ਮੈਂ ਕੰਮ ਕਰਨਾ ਹੁੰਦਾ ਅਤੇ ਮੈਨੂੰ ਮੋਸਟਲੀ ਸ਼ਾਂਤ ਪਲੇਸ ਚਾਹੀਦਾ ਹੁੰਦਾ ਹੈ ਜਿਵੇਂ ਕਿ ਆਸ ਪਾਸ ਦਾ ਵਿਊ ਅੱਛਾ ਹੋਵੇ ਬੀਚ ਵਗੈਰਾ ਹੋਵੇ ਜਿੱਥੇ ਸ਼ਾਂਤੀ ਵਗੈਰਾ ਹੋਵੇ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਸਰ ਮੇਰਾ ਤਾਂ ਅੱਸੀ ਲੱਖ ਦਾ ਹੀ ਬਜਟ ਹੈ ਸਰ ਵੇਖੋ ਨਾ ਥੋੜ੍ਹਾ ਅਜਸਟ ਕਰਕੇ ਹੋ ਜਾਏਗਾ ਸਰ ਅੱਸੀ ਤੋਂ ਉੱਪਰ ਤਾਂ ਫਿਰ ਮੈਂ ਇਕੱਠਾ ਨਹੀਂ ਦੇ ਪਾਵਾਂਗੀ ਤੁਹਾਨੂੰ ਅਤੇ ਠੀਕ ਹੈ ਅਤੇ ਉਹ ਜਿਹੜੇ ਲੋਨ ਦੀਆਂ ਕਿਸ਼ਤਾਂ ਹੋਣਗੀਆਂ ਉਹ ਕਿੰਨੇ ਕੁ ਦੇਰ ਤੱਕ ਹੋਣਗੀਆਂ ਠੀਕ ਹੈ ਠੀਕ ਹੈ ਠੀਕ ਹੈ ਸਰ ਜੀ ਸਰ ਕੋਂਟੈਕਟ ਨੰਬਰ ਇਹੀ ਰਹੇਗਾ ਹਾਂਜੀ ਅਤੇ ਜੇ ਮੈਂ ਤੁਹਾਨੂੰ ਮਿਲ ਮਿਲ ਕੇ ਗੱਲ ਕਰਨੀ ਹੋਵੇ ਤਾਂ ਆਪਾਂ ਕਿੱਥੇ ਮਿਲ ਸਕਦੇ ਹਾਂ ਐਵਰੀਡੇ ਅਵੇਲੇਬਲ ਠੀਕ ਹੈ ਸਰ ਚਲੋ ਠੀਕ ਹੈ ਸਰ ਮੈਂ ਫਿਰ ਤੁਹਾਨੂੰ ਮਿਲ ਕੇ ਗੱਲ ਕਰਦੀ ਹਾਂ ਬਾਕੀ ਓਕੇ ਥੈਂਕ ਯੂ ਸਰ